ਪਾਣੀ ਨੂੰ ਫਿਲਟਰ ਕਰਨ ਦੀ ਬਹੁਤ ਸਾਰੀ ਤਰੀਕੇ ਹਨ ਪਰ ਮੈਨੂੰ ਦੋ ਬਾਰੇ ਪਤਾ ਅਤੇ ਮੈਂ ਤੁਹਾਨੂੰ ਦੋ ਬਾਰੇ ਦੱਸ ਦਿੰਦਾ ਪਹਿਲਾ ਤਰੀਕਾ ਪਾਣੀ ਨੂੰ ਇੱਕ ਭਾਂਡੇ ਵਿੱਚ ਇਕੱਠਾ ਕਰਕੇ ਉਹਨੂੰ ਉਬਾਲੋ ਪੂਰੀ ਵਧੀਆ ਤਰੀਕੇ ਨਾਲ ਉਹਨੂੰ ਉਬਾਲੋ ਜਦੋਂ ਤੱਕ ਉੱਬਲਦਾ ਨਹੀਂ ਜਦੋਂ ਪਾਣੀ ਉੱਬਲੂਗਾ ਦੈਨ ਉਹਦੇ ਉੱਪਰ ਇੱਕ ਗੰਦੀ ਪਾਪੜੀ ਆਉਗੀ ਪਾਣੀ ਦੇ ਉੱਪਰ ਤਾਂ ਉਹ ਪਾਪੜੀ ਨੂੰ ਉਤਾਰ ਕੇ ਅਤੇ ਉਸ ਪਾਪੜੀ ਨੂੰ ਉਤਾਰ ਕੇ ਆਪਣਾ ਜਿਹੜਾ ਪਾਣੀ ਹੈ ਥੱਲੇ ਰਹਿ ਜੂਗਾ ਅਤੇ ਪਾਪੜੀ ਬਾਹਰ ਗੰਦੇ ਪਾਣੀ ਦੀ ਪਾਪੜੀ ਬਾਹਰ ਆ ਜੂਗੀ ਤਾਂ ਪਾਣੀ ਨੂੰ ਠੰਡਾ ਕਰੋ ਜੇ ਉਹਨੂੰ ਪੂਰਾ ਠੰਡਾ ਕਰਕੇ ਉਹਨੂੰ ਫਿਰ ਹੈ ਛਾਨਣੀ ਨਾਲ ਛਾਣੋ ਵੀ ਜਿਸ ਨਾਲ ਉਹਦਾ ਜੋ ਮਾੜਾ ਮੋਟਾ ਕਚਰਾ ਹੈ ਜੋ ਵੀ ਜੋ ਹੈ ਛਾਨਣੀ ਵਿੱਚ ਰਹਿ ਜੇ ਇੱਕ ਤਰੀਕਾ ਇਹ ਹੈ ਅਤੇ ਦੂਜਾ ਤਰੀਕਾ ਆਪਣਾ ਹੈਗਾ ਵੀ ਆਪਣਾ ਇੱਕ ਮਲਮਲ ਦਾ ਕੱਪੜਾ ਜੋ ਕੋਟਨ ਹੁੰਦੀ ਇੱਕ ਸਾਫ਼ ਜਿਹੀ ਉਹਦੇ ਨਾਲ ਵੀ ਆਪਾਂ ਪਾਣੀ ਨੂੰ ਹੈ ਜੋ ਫਿਲਟਰ ਕਰ ਸਕਦੇ ਹਾਂ ਇੱਕ ਗੰਦੇ ਪਾਣੀ ਨੂੰ ਲੈ ਕੇ ਮਲਮਲ ਦਾ ਕੱਪੜਾ ਵਿੱਚ ਰੱਖ ਕੇ ਅਤੇ ਦੈਂਨ ਆਪਾਂ ਨੂੰ ਜਿਹੜਾ ਗੰਦਾ ਪਾਣੀ ਹੈ ਆਪਾਂ ਦੂਜੇ ਪਾਸੇ ਜਦੋਂ ਡੋਲ੍ਹਣਾ ਤਾਂ ਮਲਮਲ ਦਾ ਕੱਪੜਾ ਵਿੱਚ ਰੱਖ ਲਉ ਤਾਂ ਜਿਹੜਾ ਵੀ ਉਹਦੇ ਵਿੱਚ ਗੰਦਾ ਰੇਤਾ ਕੁਛ ਵੀ ਹੈਗਾ ਕਣਕਣ ਹੈ ਜਿਹੜਾ ਕੰਕਰ ਹੋਊਗਾ ਉਹ ਪਾਣੀ ਮਲਮਲ ਦੇ ਕੱਪੜੇ ਦੇ ਵਿੱਚ ਫਸ ਜੂਗਾ ਜਿਸ ਨਾਲ ਕਿ ਜੋ ਆਪਣਾ ਪਾਣੀ ਹੋਊਗਾ ਪ੍ਰੋਪਰ ਆਪਣਾ ਫਿਲਟਰ ਹੋ ਕੇ ਦੂਜੇ ਪਾਸੇ ਜਾਊਗਾ ਜਿਸ ਨਾਲ ਜੋ ਮਲਮਲ ਦਾ ਕੱਪੜਾ ਹੈ ਉਹਦੇ ਵਿੱਚ ਜੋ ਵੀ ਕਚਰਾ ਜੋ ਵੀ ਗੰਦਗੀ ਜੋ ਵੀ ਮਿੱਟੀ ਹੋਊਗੀ ਉਹ ਉਹਦੇ ਵਿੱਚ ਫਸ ਜੂਗੀ ਅਤੇ ਜੋ ਸਾਫ਼ ਪਾਣੀ ਹੋਊਗਾ ਉਹ ਆਪਣਾ ਦੂਜੀ ਸਾਈਡ ਚਲ ਜੂਗਾ ਇਹ ਦੋ ਤਰੀਕੇ ਹੈ